ਮੈਂ ਹਰ ਤਰ੍ਹਾਂ ਦੇ ਗਲੇ ਤਿਆਰ ਕਰ ਸਕਦੀ ਹਾਂ ਜਿਵੇਂ ਜਿੱਦਾਂ ਦਾ ਵੀ ਕੋਈ ਕਹਿੰਦਾ ਹੈ ਮੈਨੂੰ ਘਰੇ ਘਰ ਬਣਾ ਦਿੰਦੀ ਹਾਂ ਜਾਂ ਜਿਵੇਂ ਬਜ਼ਾਰੋਂ ਵੀ ਲਿਆਉਣ ਵਾਲੇ ਹੋਣ ਘਰ ਬਣਾਉਣ ਵਾਲੇ ਜਿਵੇਂ ਥੋੜ੍ਹੀ ਮੁਸ਼ਕਿਲ ਹੁੰਦੇ ਹਨ ਘਰ ਸਰ ਲਿਆਉਣੀਆਂ ਪੈਂਦੀਆਂ ਚੀਜ਼ਾਂ ਅਤੇ ਬਜ਼ਾਰੋਂ ਜਿਵੇਂ ਲਿਆਓ ਤਾਂ ਫਿਰ ਜਿੱਦਾਂ ਦਾ ਕੋਈ ਚਾਹੁੰਦਾ ਉੱਦਾਂ ਦੀ ਚੀਜ਼ ਮਿਲ ਜਾਂਦੀ ਹੈ ਤਾਂ ਫਿਰ ਉਹ ਵੀ ਖੁਸ਼ ਹੋ ਜਾਂਦੇ ਹਨ ਅਤੇ ਅਸੀਂ ਵੀ ਖੁਸ਼ ਹੈਗੇ ਹਾਂ ਬਾਕੀ ਦੇਖੋ ਇਹਨਾਂ ਦੇ ਵਿੱਚ ਫਰਕ ਤਾਂ ਹੁੰਦਾ ਹੀ ਆ ਜਿਹੜੀ ਘਰ ਦੀ ਚੀਜ਼ ਹੋਏਗੀ ਜਿਹੜੀ ਘਰ ਬਣਾਵਾਂਗੇ ਉਹ ਥੋੜ੍ਹੀ ਸਸਤੀ ਪੈਂਦੀ ਹੈ ਅਤੇ ਜਿਹੜੀ ਬਜ਼ਾਰੋਂ ਲਿਆਵਾਂਗੇ ਉਹ ਥੋੜ੍ਹੀ ਮਹਿੰਗੀ ਪੈਂਦੀ ਆ ਬਾਕੀ ਹੁਣ ਠੀਕ ਆ